ਸਾਡੇ ਖੇਤਰ ਵਿੱਚ ਧਾਰਮਿਕ ਪਰੰਪਰਾਵਾਂ ਹਨ ਕਿ ਜੋ ਸਿੱਖੀ ਨੂੰ ਮੰਨਦਾ ਹੈ ਸਿੱਖ ਧਰ ਸਿੱਖੀ ਧਾਰਨ ਕਰਦਾ ਹੈ ਉਹ ਆਪਣੇ ਕੇਸ ਕਤਲ ਨਹੀਂ ਕਰਦਾ ਗਾਤਰਾ ਕਿਰਪਾਨ ਪਹਿਨਦਾ ਹੈ ਕਛਹਿਰਾ ਕੇਸ ਸਾਰਾ ਕੁਛ ਪੰਜ ਕਕਾਰ ਧਾਰਨ ਕਰਦਾ ਹੈ ਰੀਤੀ ਰਿਵਾਜ਼ ਹੈ ਕਿ ਪ੍ਰਾਥਨਾਵਾਂ ਵੀ ਹੁੰਦੀਆਂ ਹਨ ਸਵੇਰੇ ਸ਼ਾਮ ਪੰਜਾਂ ਬਾਣੀਆਂ ਦਾ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੁੰਦਾ ਹੈ ਰਸਮਾਂ ਰਸਮਾਂ ਵੀ ਇਹਦੇ ਵਿੱਚ ਕੋਈ ਜ਼ਰੂਰੀ ਜ਼ਿਆਦਾ ਨਹੀਂ ਹਨ ਕਿ ਅਸੀਂ ਆਪਣੇ ਗੁਰੂ ਨੂੰ ਮੰਨਣਾ ਹੈ ਗੁਰੂ 'ਤੇ ਵਿਸ਼ਵਾਸ ਰੱਖਣਾ ਹੈ ਤੀਰਥ ਯਾਤਰਾਵਾਂ ਸਭ ਤੋਂ ਵੱਡਾ ਤੀਰਥ ਜਿ ਜਿਹੜਾ ਸਾਡਾ ਹੈ ਔਰ ਅੰਮ੍ਰਿਤਸਰ ਹਰਿਮੰਦਰ ਸਾਹਿਬ ਹੈ ਔਰ ਇਹ ਸਾਰਾ ਕੁਛ ਸਾਡੇ ਧਾਰਮਿਕ ਅਭਿਆਸਾਂ ਦਾ ਹੀ ਹਿੱਸਾ ਹੈ